ਹਾਂਜੀ ਮੈਂ ਪਰਮਵੀਰ ਸਿੰਘ ਜੋ ਕਿ ਸਰਕਾਰ ਦਾ ਇੱਕ ਸਰਕਾਰੀ ਮੁਲਾਜ਼ਮ ਹਾਂ ਅਤੇ ਮੈਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਮੇਰੀ ਡਿਊਟੀ ਪੰਜਾਬ ਰਾਜ ਵਿੱਚ ਲਗਾ ਦਿੱਤੀ ਗਈ ਹੈ ਆਪਣੇ ਇਸ ਜ਼ਿਲ੍ਹੇ ਦੇ ਵਿੱਚ ਮੈਂ ਹੁਣ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਅਤੇ ਮੈਂ ਕਾਫੀ ਲੰਮੇ ਸਮੇਂ ਤੋਂ ਆਪ ਜੀ ਦੀ ਕੰਪਨੀ ਦਾ ਜੋ ਗੈਸ ਕਨੈਕਸ਼ਨ ਹੈ ਗੈਸ ਸਿਲੰਡਰ ਹੈ ਕਨੈਕਸ਼ਨ ਹੈ ਮੈਂ ਉਸਦੀ ਵਰਤੋਂ ਕਰ ਰਿਹਾ ਹਾਂ ਅਤੇ ਹੁਣ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਹੁਣ ਮੈਂ ਜਿਹੜੀ ਮੇਰੀਆਂ ਸੇਵਾਵਾਂ ਨੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੁਣ ਮੈਂ ਇੱਥੇ ਨਿਭਾ ਰਿਹਾ ਹਾਂ ਸੋ ਕੰਪਨੀ ਦੀਆਂ ਹਦਾਇਤਾਂ ਦੇ ਮੁਤਾਬਕ ਸ਼ਿਫਟਿੰਗ ਦੇ ਦੌਰਾਨ ਜਦੋਂ ਬਦਲੀ ਦੇ ਦੌਰਾਨ ਮੈਨੂੰ ਹੁਣ ਆਪਣਾ ਗੈਸ ਸਲੰਡਰ ਦਾ ਜੋ ਮੇਰੇ ਪਾਸ ਕਨੈਕਸ਼ਨ ਹੈ ਮੈਨੂੰ ਉਸਦੀ ਵੀ ਨਾਮ ਜਾਂ ਪਤੇ ਦੀ ਤਬਦੀਲੀ ਹੁਣ ਕਰਵਾਉਣੀ ਪਏਗੀ ਸੋ ਹੁਣ ਮੈਂ ਆਪ ਨੂੰ ਬੇਨਤੀ ਹੈ ਕਿ ਮੇਰਾ ਜਿਹੜਾ ਜੋ ਗੈਸ ਸਿਲੰਡਰ ਹੈ ਮੇਰੀ ਆਈ ਡੀ ਵੰਨ ਵੰਨ ਜੀਰੋ ਜੀਰੋ ਭਾਵ ਇੱਕ ਇੱਕ ਜੀਰੋ ਜੀਰੋ ਦੋ ਦੋ ਇੱਕ ਹੈ ਅਤੇ ਜੋ ਨਵਾਂ ਮੇਰਾ ਪਤਾ ਹੈ ਉਹ ਪੰਜਾਬ ਦੇ ਵਿੱਚ ਏ ਬੀ ਸੀ ਮੁਹੱਲਾ ਮਕਾਨ ਨੰਬਰ ਇਕ ਦੋ ਤਿੰਨ ਚਾਰ ਅਤੇ ਜ਼ਿਲ੍ਹਾ ਐਕਸ ਵਾਈ ਜੈੱਡ ਹੈ ਸੋ ਕਿਰਪਾ ਕਰਕੇ ਸੋ ਮੇਰਾ ਜੋ ਗੈਸ ਸਿਲੰਡਰ ਗੈਸ ਕਨੈਕਸ਼ਨ ਹੈ ਉਸਨੂੰ ਉਕਤ ਪਤੇ 'ਤੇ ਬਦਲਣ ਲਈ ਬੇਨਤੀ ਕੀਤੀ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ